ਹਾਂਜੀ ਮੈਂ ਕਿਸੇ ਇੱਕ ਆਪਣੇ ਦੋਸਤ ਦੇ ਜਨਮਦਿਨ 'ਤੇ ਉਸ ਨੂੰ ਇੱਕ ਸ਼ਾਇਰ ਗ ਲਿਖ ਕੇ ਦਿੱਤਾ ਸੀ ਉਸ ਨੂੰ ਉਹ ਸ਼ਾਇਰ ਬਹੁਤ ਜ਼ਿਆਦਾ ਪਸੰਦ ਆਇਆ ਕਿਉਂਕਿ ਉਸ ਨੂੰ ਉਹ ਮੈਂ ਪਹਿਲੀ ਵਾਰ ਜ਼ਿੰਦਗੀ ਵਿੱਚ ਕੀਤਾ ਸੀ ਮੈਂ ਅੱਜ ਤੱਕ ਕਦੇ ਕੋਈ ਸ਼ਾਇਰ ਨਹੀਂ ਕੀਤਾ ਲਿਖਿਆ ਕੋਈ ਕ ਕਵਿਤਾ ਨਹੀਂ ਲਿਖੀ ਸੀ ਪਰ ਮੈਂ ਉਹ ਮੇਰਾ ਖਾਸ ਦੋਸਤ ਸੀ ਮੇਰਾ ਬਹੁਤ ਜ਼ਿਆਦਾ ਕਲੋਜ ਫਰੈਂਡ ਸੀਗਾ ਅਤੇ ਉਸਨੇ ਮੈਨੂੰ ਬੇਨਤੀ ਕੀਤੀ ਸੀ ਕਿ ਜੇ ਤੂੰ ਮੇਰੇ ਲਈ ਹੋ ਸਕਦਾ ਤਾਂ ਕਦੇ ਇੱਕ ਇੱਕ ਚਾਰ ਲਾਈਨਾਂ ਦਾ ਸ਼ਬਦ ਜ਼ਰੂਰ ਲਿਖ ਕੇ ਮੈਨੂੰ ਤੂੰ ਅਰਪਿਤ ਕਰੀ ਤਾਂ ਮੈਂ ਉਸਦੀ ਇਸ ਬੇਨਤੀ 'ਤੇ ਮੈਂ ਬਹੁਤ ਜ਼ਿਆਦਾ ਸੋਚਿਆ ਵਿਚਾਰਿਆ ਰਿਹਾ ਅਤੇ ਘਰ ਬੈਠੇ ਨੇ ਕੁਝ ਲਾਈਨਾਂ ਜੋੜੀਆਂ ਜੋੜ ਕੇ ਫਿਰ ਮੈਂ ਉਹਨਾਂ ਦਾ ਇੱਕ ਤੁਕ ਬਣਾਇਆ ਫਿਰ ਤੁਕ ਬਣਾ ਕੇ ਫਿਰ ਮੈਂ ਉਸ ਨੂੰ ਲਿਖਿਆ ਲਿਖ ਕੇ ਫਿਰ ਮੈਂ ਉਸ ਨੂੰ ਪੜ੍ਹ ਕੇ ਕ ਪੜ੍ਹ ਕੇ ਕੁਛ ਜੋੜ ਕੇ ਕੋਸ਼ਿਸ਼ ਕੀਤੀ ਕਿ ਇਸ ਦਾ ਇੱਕ ਪੂਰਾ ਸ਼ ਸ਼ਾਇਰ ਸ਼ੇਅਰ ਬਣ ਜਾਵੇ ਫਿਰ ਮੈਂ ਉਸਨੂੰ ਆਪਣੇ ਇੱਕ ਕਲੋਜ਼ ਰਿਸ਼ਤੇਦਾਰ ਨੂੰ ਸੁਣਾ ਕੇ ਦੇਖਿਆ ਉਸ ਨੇ ਕਿਹਾ ਇੱਕ ਬਹੁਤ ਵਧੀਆ ਫਿਰ ਮੈਂ ਆਪਣੇ ਉਸ ਦੋਸਤ ਨੂੰ ਇਹ ਇੱਕ ਕਾਰਡ ਦੇ ਉੱਤੇ ਲਿਖ ਕੇ ਅਰਪਿਤ ਕੀਤਾ ਜੋ ਕਿ ਉਸ ਨੇ ਪੜ੍ਹਿਆ ਤਾਂ ਉਸਨੂੰ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਸਨੇ ਮੇਰਾ ਧੰਨਵਾਦ ਕੀ